ਜਾਨਵਰਾਂ ਨਾਲ ਮੇਰਾ ਬਹੁਤ ਹੀ ਪਿਆਰਾ ਅਤੇ ਗੂੜ੍ਹਾ ਰਿਸ਼ਤਾ ਹੈ ਸਭ ਤੋਂ ਵਫਾਦਾਰ ਜਾਨਵਰ ਹੈ ਕੁੱਤਾ ਅਸੀਂ ਵੀ ਇੱਕ ਕੁੱਤਾ ਰੱਖਿਆ ਹੈ ਜਿਹੜਾ ਕਿ ਲੈਬਰੇ ਨਸਲ ਦਾ ਹੈ ਬਲੈਕ ਕਲਰ ਦਾ ਕਾਲੇ ਕਲਰ ਦਾ ਕੁੱਤਾ ਐਨਾ ਕੁ ਸਮਝਦਾਰ ਜਾਨਵਰ ਹੈ ਵੀ ਤੁਸੀਂ ਉਹਨੂੰ ਜਿੱਦਾਂ ਸਿਖਾਉਂਗੇ ਉਹਨੇ ਉੱਦਾਂ ਸਿੱਖਣਾ ਜੇ ਤੁਸੀਂ ਉਹਨੂੰ ਜ਼ਿਆਦਾ ਜ਼ਿਆਦਾ ਭੈੜਾ ਬਣਾਉਣਾ ਗਾ ਹੈ ਨਾ ਤਾਂ ਉਹਨੇ ਉੱਦਾਂ ਬਣ ਜਾਣਾ ਜੇ ਉਹਨੂੰ ਫਰੈਂਡਲੀ ਤੌਰ 'ਤੇ ਬਣਾਉਣਾ ਗਾ ਤਾਂ ਉਹ ਉੱਦਾਂ ਹੋ ਜਾਂਦਾ ਗਾ ਮੇਰੇ ਕੁੱਤੇ ਦਾ ਨਾਮ ਸੀਗਾ ਟੋਕੀਓ ਜਿਹੜਾ ਕਿ ਮੈਂ ਦੋ ਸਾਲ ਪਹਿਲਾਂ ਲੈ ਕੇ ਆਇਆ ਸੀਗਾ ਉਹ ਉਹਦੇ ਨਾਲ ਮੇਰਾ ਬਹੁਤ ਹੀ ਵਧੀਆ ਮੋਹ ਪ੍ਰੇਮ ਸੀਗਾ ਉਹ ਜਦੋਂ ਉਹਨੂੰ ਭੁੱਖ ਲੱਗਦੀ ਉਹਨੇ ਆ ਕੇ ਮੇਰੇ ਲੱਤਾਂ ਨੂੰ ਚਿੰਬੜ ਜਾਣਾ ਜਿੱਦਾਂ ਕਿ ਇੱਕ ਬੱਚਾ ਆਪਦੀ ਮਾਂ ਨੂੰ ਕਹਿ ਰਿਹਾ ਹੋਵੇ ਦੁੱਧ ਵਾਸਤੇ ਹੈ ਨਾ ਵੀ ਭੁੱਖ ਬਹੁਤ ਲੱਗੀ ਹੋਵੇ ਜਿਵੇਂ ਭੁੱਖ ਜ਼ਾਹਰ ਕਰਦਾ ਹੋਵੇ ਮੈਂ ਨਿੱਕਾ ਜਿਹਾ ਲੈ ਕੇ ਆਇਆ ਉਹਨੂੰ ਮੈਂ ਅਤੇ ਉਹ ਚੌਵੀ ਘੰਟੇ ਮੇਰੇ ਪਿੱਛੇ ਪਿੱਛੇ ਪਿੱਛੇ ਪਿੱਛੇ ਮੇਰੇ ਚੌਵੀ ਘੰਟੇ ਲੱਤ 'ਤੇ ਚਿੰਬੜਿਆ ਰਹਿੰਦਾ ਜਦੋਂ ਮੈਂ ਸੌਣਾ ਤਾਂ ਉਹਨੇ ਮੇਰੇ ਨਾਲ ਸੌਣਾ ਹਮੇਸ਼ਾ ਮੇਰੇ ਨਾਲ ਨਾਲ ਰਹਿੰਦਾ ਸਾਡੇ ਘਰਦਿਆਂ ਨਾਲ ਵੀ ਬਹੁਤ ਘੁੱਲ ਮਿਲ ਗਿਆ ਸੀਗਾ ਉਹ ਹਰ ਇੱਕ ਨਾਲ ਮੋਹ ਪ੍ਰੇਮ ਪੈ ਗਿਆ ਸੀ ਉਹ ਕੁੱਤੇ ਦਾ